ਜਦੋਂ ਮੈਂ ਗਾਉਂਦੀ ਹਾਂ ਤਾਂ ਮੈਂ ਗਾਣੇ ਦੇ ਭਾਵਨਾ ਨੂੰ ਦਰਸਾਉਣ ਲਈ ਆਪਣੇ ਸਰੀਰ ਅਤੇ ਚਿਹਰੇ ਦੇ ਹਾਵ ਭਾਵ ਦੀ ਵਰਤੋਂ ਕਰਦੀ ਹਾਂ ਜੋ ਜੋ ਗਾਣਾ ਉਦਾਸ ਹੈ ਤਾਂ ਮੇਰੀ ਅੱਖਾਂ ਨੀਵੀਆਂ ਹੋ ਜਾਂਦੀਆਂ ਹਨ ਅਤੇ ਸਰੀਰ ਹੌਲੀ ਅਹਲ ਅਹਲ ਹਿਲਦਾ ਹੈ ਅਤੇ ਜੇ ਖੁਸ਼ੀ ਵਾਲਾ ਹੋਵੇ ਤਾਂ ਮੈਂ ਮੁਸਕਰਾਉਂਦੀ ਹਾਂ ਅਤੇ ਹੱਥਾਂ ਨੂੰ ਤੇਜ਼ੀ ਨਾਲ ਹਿਲਾਉਂਦੀ ਹਾਂ ਇਸ ਤਰ੍ਹਾਂ ਮੈਂ ਗਾਣੇ ਨੂੰ ਦਿਲ ਦਿਲਚਸ ਅਤੇ ਭਾਵਨਾ ਨਾਲ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਜੋ ਸੁਣਨ ਵਾਲੇ ਗਾਣੇ ਨਾਲ ਜੁੜ ਜਾ ਜੁੜ ਸਕਦਾ ਹਾਂ ਸਕਦੀ ਹਾਂ ਧੰਨਵਾਦ